ਪਿਛਲੇ ਕੁਝ ਦਹਾਕਿਆਂ ਦੌਰਾਨ ਭਾਰਤ ਵਿੱਚ ਕੁਝ ਨਵੀਆਂ ਨੌਕਰੀਆਂ ਅਤੇ ਭੂਮਿਕਾਵਾਂ ਆਈਆਂ ਹਨ ਜਿਵੇਂ ਕਿ ਯੂਟਿਊਬਰ ਕਮੇਡੀਅਨ ਯਾਤਰੀ ਆਦਿ ਯੂਟਿਊਬਰ ਯੂਟਿਊਬ ਦੇ ਮਾਧਿਅਮ ਤੋਂ ਵੀਡੀਓਜ ਬਣਾ ਕੇ ਲੋਕਾਂ ਨੂੰ ਮਨੋਰੰਜਨ ਕਰਦੇ ਹਨ ਉਹਨਾਂ ਨੂੰ ਵੱਖ ਵੱਖ ਚੀਜ਼ਾਂ ਦੀ ਵੱਖ ਵੱਖ ਥਾਵਾਂ ਦੀ ਜਾਣਕਾਰੀ ਦਿੰਦੇ ਹਨ ਇਹ ਬਹੁਤ ਹੀ ਸਹਾਇਕ ਜਾਪਦਾ ਹੈ ਅਤੇ ਅੱਜ ਕੱਲ੍ਹ ਇਹ ਬਹੁਤ ਹੀ ਟਰੈਂਡ ਵਿੱਚ ਚੱਲ ਰਿਹਾ ਹੈ ਅਤੇ ਟਿਊਰਿਸਟ ਗਾਈਡ ਟੂਰਿਸਟ ਗਾਈਡ ਵੀ ਅੱਜ ਕੱਲ੍ਹ ਬਹੁਤ ਡਿਮਾਂਡ ਹੈ ਕਿਉਂਕਿ ਭਾਰਤ ਵਿੱਚ ਟਿਊਜ ਟਿਊਰੀਜਮ ਬਹੁਤ ਹੀ ਵੱਧ ਗਿਆ ਹੈ ਇਸ ਕਾਰਨ ਵੱਖ ਵੱਖ ਦੇਸ਼ਾਂ ਤੋਂ ਬਾਹਰ ਤੋਂ ਆਏ ਟੂਰਿਸਟ ਨੂੰ ਟੂਰਿਸਟ ਗਾਈਡ ਦੀ ਲੋੜ ਪੈਂਦੀ ਹੈ ਇਸ ਕਰਕੇ ਭਾਰਤ ਵਿੱਚ ਟਿਊਰਿਸਟ ਗਾਈਡ ਦੀ ਵੀ ਬਹੁਤ ਡਿਮਾਂਡ ਹੈ ਕਮੇਡੀਅਨ ਕਮੇਡੀਅਨ ਦਾ ਕੰਮ ਲੋਕਾਂ ਨੂੰ ਮਨੋਰੰਜਨ ਕਰਨਾ ਅਤੇ ਲੋਕਾਂ ਦਾ ਮਨ ਬਹਿਲਾਉਣਾ ਹੈ ਜਿਵੇਂ ਕਿ ਅੱਜ ਕੱਲ੍ਹ ਸਟੈਂਡ ਅੱਪ ਕਮੇਡੀ ਬੜੇ ਹੀ ਟਰੈਂਡ ਵਿੱਚ ਚੱਲ ਰਹੀ ਹੈ ਅਤੇ ਇਸ ਦੀ ਵੀ ਬਹੁਤ ਹੀ ਡਿਮਾਂਡ ਹੈ ਅੱਜ ਕੱਲ੍ਹ ਦੇ ਨੌਜਵਾਨ ਜ਼ਿੰਦਗੀ ਵਿੱਚ ਐਸ਼ੋ ਆਰਾਮ ਭਾਲਦੇ ਹਨ ਉਹ ਭਾਲਦੇ ਹਨ ਕਿ ਉਹਨਾਂ ਨੂੰ ਕੋਈ ਕੰਮ ਨਾ ਕਰਨਾ ਪਵੇ ਪਰੰਤੂ ਉਹਨਾਂ ਨੂੰ ਸਹੂਲਤਾਂ ਵੀ ਸਾਰੀਆਂ ਚਾਹੀਦੀਆਂ ਹਨ ਇਸ ਕਰਕੇ ਅੱਜ ਕੱਲ੍ਹ ਦੀ ਨੌਜਵਾਨ ਜ਼ਿੰਦਗੀ ਵਿੱਚ ਐਸ਼ੋ ਆਰਾਮ ਭਾਲਦੀ ਹੈ